ਸਾਡੇ ਅੰਮ੍ਰਿਤਸਰ ਵਿੱਚ ਸਭ ਤੋਂ ਪ੍ਰਸਿੱਧ ਖੇਡ ਕ੍ਰਿਕਟ ਹੈ ਹਰ ਐਤਵਾਰ ਭਾਰੀ ਭਾਰੀ ਗਿਣਤੀ ਵਿੱਚ ਲੋਕ ਇੱਕਠੇ ਹੁੰਦੇ ਹਨ ਗਰਾਊਂਡਾ ਵਿੱਚ ਜਾ ਕੇ ਆ ਕ੍ਰਿਕਟ ਦੇ ਮੈਚ ਲਗਾਉਂਦੇ ਹਨ ਇਹਨਾਂ ਮੈਚ ਇਹਨਾਂ ਨੂੰ ਦੇਖਣ ਲਈ ਕਾਫੀ ਲੋਕ ਆਉਂਦੇ ਹਨ ਬੋਲੀ ਲੱਗ ਬੋਲੀ ਲਗਾਈ ਜਾਂਦੀ ਹਨ ਪੈਸੇ ਲਗਾਏ ਜਾਂਦੇ ਹਨ ਕਈ ਲੋਕ ਖੁਸ਼ੀ ਖੁਸ਼ੀ ਵਿੱਚ ਕਿਸੇ ਨੂੰ ਕ੍ਰਿਕਟ ਬੈਟ ਕਦੀ ਕੁਛ ਕਦੀ ਕੁਛ ਕੀ ਇਨਾਮ ਦਿੰਦੇ ਹਨ ਇਹਨਾਂ ਨੂੰ ਬਹੁਤ ਵੱਡੇ ਲੈਵਲ ਤੱਕ ਖੜ੍ਹਨ ਦੀ ਉਮੀਦ ਕੀਤੀ ਜਾਂਦੀ ਹਨ ਬੜੇ ਲੋਕ ਇਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਕਈ ਕਈ ਲੋਕ ਇਹਨਾਂ ਇਹ ਚੀਜ਼ ਸਿੱਖਣ ਲਈ ਆਉਂਦੇ ਹਨ ਅਤੇ ਕਈ ਲੋਕ ਇਹਨਾਂ ਨੂੰ ਦੇਖ ਕੇ ਬਸ ਆਪਾਂ ਆਪਣੀ ਖੁਸ਼ੀ ਲਈ ਆਉਂਦੇ ਹਨ ਕਈ ਛੋਟੇ ਛੋਟੇ ਬੱਚੇ ਲੈ ਕੇ ਵੀ ਆਉਂਦੇ ਹਨ ਜਿਨ੍ਹਾਂ ਦੇ ਪਰਿਵਾਰ ਵਿੱਚ ਕੋਈ ਵੱਡਾ ਬਜ਼ੁਰਗ ਖੇਡਦਾ ਹੈ ਉਨ ਉਹਨਾਂ ਦੇ ਨਾਲ ਨਾਲ ਛੋਟੇ ਨਿਆਣੇ ਵੀ ਆਉਂਦੇ ਹਨ ਬੜੀ ਚੀਜ਼ਾਂ ਨੂੰ ਦੇਖ ਕੇ ਸਾਰੇ ਲੋਕ ਬਹੁਤ ਪ੍ਰਸਿੱਧ ਹੁੰਦੇ ਹਨ ਅਸੀਂ ਵੀ ਅਸੀਂ ਚਾਹੁੰਦੇ ਹਾਂ ਕੀ ਇਹ ਖੇਡ ਅੰਮ੍ਰਿਤਸਰ ਲੈਵਲ ਵਿੱਚ ਬਹੁਤ ਉੱਪਰ ਤੱਕ ਜਾਵੇ ਜਿਸ ਨੂੰ ਦੇਖ ਕੇ ਸਾਡਾ ਦਿਲ ਵੀ ਬਹੁਤ ਖੁਸ਼ ਹੁੰਦਾ ਹੈ ਇਹ ਖੇਡ ਲੋਕਾਂ ਨੂੰ ਫਿੱਟ ਵੀ ਰੱਖਦੀ ਹੈ ਜਿਹਦੇ ਨਾਲ ਨਾਲ ਉਹਨਾਂ ਬਿਮਾਰੀਆਂ ਤੋਂ ਦੂਰ ਵੀ ਰਹਿੰਦੇ ਹਨ ਇਸੇ ਇਸੇ ਚੀਜ਼ ਲਈ ਸਾਰਿਆਂ ਨੇ ਆਪਣਾ ਕੰਮ ਕਰਦੇ ਹਨ ਉਹ ਸਿਰਫ਼ ਹਫ਼ਤੇ 'ਚ ਇੱਕ ਦਿਨ ਦਾ ਟਾਈਮ ਕੱਢਦੇ ਹਨ ਸਵੇਰੇ ਸਵੇਰੇ ਸੱਤ ਕੁ ਵਜੇ ਨਾ ਉੱਠ ਜਾਂਦੇ ਹਨ ਮੈਂ ਵੀ ਇਸ ਖੇਡ ਨੂੰ ਐਤਵਾਰ ਦੇ ਐਤਵਾਰ ਖੇਡਦਾ ਹਾਂ ਜਿਸ ਜਿਸ ਨਾਲ ਮੇਰਾ ਸਰੀਰ ਫਿੱਟ ਫਿੱਟ ਰਹਿੰਦਾ ਹੈ ਤੰਦਰੁਸਤ ਰਹਿੰਦਾ ਹੈ ਜਿਹਦੇ ਨਾਲ ਮੈਨੂੰ ਕੋਈ ਬਿਮਾਰੀ ਨਹੀਂ ਲੱਗਦੀ